ਖੇਡਾਂ ਨਾਲ ਸਬੰਧਿਤ ਹਿੰਸੇ ਦੇ ਮੁੱਦੇ ਬਹੁਤ ਹਨ ਜਿਵੇਂ ਕਿ ਭਾਰਤ ਪਾਕਿਸਤਾਨ ਦਾ ਕ੍ਰਿਕਟ ਦਾ ਮੈਚ ਹੁੰਦਾ ਹੈ ਤਾਂ ਬਹੁਤ ਦੂਰੋਂ ਦੂਰੋਂ ਦਰਸ਼ਕ ਮੈਚ ਦੇਖਣ ਆਏ ਹੁੰਦੇ ਹਨ ਜਿਹਨਾਂ ਨੂੰ ਧਿਆਨ ਦੇ ਰੱਖਣ ਲਈ ਬਹੁਤ ਸਾਰੀ ਥਾਂ ਥਾਂ 'ਤੇ ਪੁਲਿਸ ਲੱਗੀ ਹੁੰਦੀ ਹੈ ਤਾਂ ਕਿ ਕੋਈ ਦੁਰਘਟਨਾ ਨਾ ਹੋ ਜਾਵੇ ਥਾਂ ਥਾਂ 'ਤੇ ਸਕੈਨਰ ਜੈਮਰ ਲੱਗੇ ਹੋਏ ਹੁੰਦੇ ਹਨ ਅਤੇ ਹਾਈ ਸਕੋਲਟੀ ਅਲਰਟ ਦਾ ਪਾਲਣ ਕਰਦੀ